ਖਾਣਾ ਰੋਟੀ ਜੋ ਕਿ ਸਾਡੇ ਹਰ ਰੋਜ਼ ਦੇ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਰੋਟੀ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਅਸੀਂ ਉਸ ਨਾਲ ਬਹੁਤ ਕੰਮ ਕਰ ਸਕਦੇ ਹਾਂ ਜਦੋਂ ਤੱਕ ਸਾਡੇ ਸਰੀਰ 'ਚ ਤਾਕਤ ਹੀ ਨਹੀਂ ਹੋਵੇਗੀ ਤਾਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਅਤੇ ਮੁੱਦਾ ਪਰ ਇਹ ਉੱਠਦਾ ਹੈ ਕਿ ਖਾਣਾ ਬਣਾਉਣਾ ਸਿਰਫ ਔਰਤਾਂ ਦਾ ਕੰਮ ਹੈ ਮੇਰਾ ਜਵਾਬ ਹੈ ਨਹੀਂ ਹਰ ਕੋਈ ਇਨਸਾਨ ਮਰਦ ਬੱਚਾ ਸਭ ਖਾਣੇ ਬਣਾ ਸਕਦੇ ਨੇ ਤੁਸੀਂ ਵੱਡੇ ਵੱਡੇ ਰੈਸਟੋਰੈਂਟ ਹੀ ਵੇਖ ਲਓ ਹੋਟਲਾਂ ਵੇਖ ਲਓ ਉੱਥੇ ਸਭ ਮਰਦ ਹੀ ਖਾਣਾ ਬਣਾਉਂਦੇ ਨੇ ਖਾਸਕਰ ਢਾਬੇ ਦੇਖ ਲਓ ਖਾਣਾ ਬਣਾਉਣਾ ਕੋਈ ਸ਼ਰਮਿੰਦਗੀ ਦੀ ਗੱਲ ਨਹੀਂ ਹੈ ਸਗੋਂ ਆਪਣੇ ਸਰੀਰ ਨੂੰ ਜਿਸ ਚੀਜ਼ ਨਾਲ ਤਾਕਤ ਮਿਲਦੀ ਹੈ ਉਹ ਚੀਜ਼ ਬਣਾ ਕੇ ਖਾਣ 'ਚ ਕਿਸ ਤਰ੍ਹਾਂ ਦੀ ਸ਼ਰਮ ਬਸ ਕੁਛ ਲੋਕ ਇਸ ਨੂੰ ਬਹੁਤ ਹੀ ਘਟੀਆ ਨਜ਼ਰ ਨਾਲ ਦੇਖਦੇ ਨੇ ਕਿ ਮਰਦ ਖਾਣਾ ਨਹੀਂ ਬਣਾ ਸਕਦੇ ਘਟੀਆ ਉਹਨਾਂ ਦੀ ਨਜ਼ਰ ਨਹੀਂ ਘਟੀਆ ਉਹਨਾਂ ਦੀ ਸੋਚ ਹੈ ਖਾਣਾ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ ਸਰੀਰ ਲਈ ਮੇਰੇ ਘਰ ਵਿੱਚ ਤਾਂ ਮੈਂ ਮੇਰਾ ਬਾਪੂ ਮੇਰਾ ਭਰਾ ਸਭ ਖਾਣਾ ਬਣਾਉਂਦੇ ਨੇ ਕੋਈ ਕਦੇ ਕਦੇ ਮਾਤਾ ਜੀ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਕਿ ਉਹ ਖਾਣਾ ਬਣਾ ਸਕਣ ਇਸ ਕਰਕੇ ਕਦੇ ਕਦੀ ਮੈਂ ਮੇਰਾ ਬਾਪੂ ਅਸੀਂ ਇਕੱਠੇ ਖਾਣਾ ਬਣਾਉਂਦੇ ਨੇ ਅਤੇ ਸਾਨੂੰ ਇਸ ਵਿੱਚ ਬਹੁਤ ਮਜ਼ਾ ਆਉਂਦਾ ਹੈ ਖਾਣਾ ਬਣਾਉਣ ਦੇ ਨਾਲ ਨਾਲ ਅਸੀਂ ਨਵੀਂ ਨਵੀਂ ਚੀਜ਼ਾਂ ਸਿੱਖ ਸਕਦੇ ਹਾਂ ਕਿ ਕਿਹੜੇ ਮਸਾਲੇ ਕਿਸ ਤਰ੍ਹਾਂ ਪੈਂਦੇ ਨੇ ਕਿਸ ਤਰ੍ਹਾਂ ਨਹੀਂ ਤਾਂ ਕਿ ਕੱਲ ਨੂੰ ਨਹੀਂ ਪਤਾ ਕਿ ਕੀ ਸਥਿਤੀ ਰਹਿਣੀ ਹੈ ਕਦੋਂ ਕਿਹਨੂੰ ਆਪੇ ਖਾਣਾ ਬਣਾ ਕੇ ਖਾਣਾ ਪੈ ਜੇ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਹਰ ਇੱਕ ਬੰਦੇ ਨੂੰ ਖਾਣਾ ਖਾਣਾ ਆਉਣਾ ਚਾਹੀਦਾ ਹੈ ਬਣਾਉਣਾ ਆਉਣਾ ਚਾਹੀਦਾ ਹੈ ਅਤੇ ਹਰ ਸਕੂਲਾਂ ਵਿੱਚ ਵੀ ਮੈਂ ਚਾਹੁੰਦਾ ਹਾਂ ਕਿ ਸਿਖਾਇਆ ਜਾਵੇ ਕਿ ਖਾਣਾ ਬਣਾਉਣਾ ਇੱਕ ਵੱਖਰੀ ਹੀ ਕਲਾਸ ਲਗਵਾਈ ਜਾਵੇ ਚਾਹੇ ਹਫਤੇ 'ਚ ਇੱਕ ਵਾਰੀ ਲੱਗੇ ਬਟ ਸਾਰਿਆਂ ਨੂੰ ਖਾਣਾ ਬਣਾਉਣਾ ਆਉਣਾ ਚਾਹੀਦਾ ਹੈ ਜ਼ਿਆਦਾ ਨਹੀਂ ਤਾਂ ਮੈਗੀ ਚਾਹ ਅਤੇ ਰੋਟੀ ਸਾ ਹਰ ਇੱਕ ਆਉਣੀ ਚਾਹੀਦੀ ਹੈ ਬਣਾਉਣੀ